ਅੱਜ ਤੁਹਾਨੂੰ ਅਸੀਂ ਦੱਸਾਂਗੇ ਵੀ ਸਾਡੇ ਸਟੇਟ ਦੀ ਟਰਾਂਸਪੋਰਟ ਦੀ ਕੁਆਲਿਟੀ ਕਿਵੇਂ ਦੀ ਹੈ ਸਾਡੇ ਸਟੇਟ ਦੇ ਟਰਾਂਸਪੋਰਟ ਦੀ ਕੁਆਲਿਟੀ ਠੀਕ ਠਾਕ ਹੈ ਜਿਵੇਂ ਵੀ ਕਿਸੇ ਨੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣਾ ਹੋਵੇ ਅਤੇ ਸਫਰ ਕਰਨਾ ਹੋਵੇ ਤਾਂ ਉਹ ਬੱਸ ਦੀ ਮਦਦ ਨਾਲ ਜਾ ਸਕਦਾ ਹੈ ਉਹ ਪਹਿਲਾਂ ਤਾਂ ਬਹੁਤ ਹੀ ਭੀੜ ਭੜੱਕਾ ਹੁੰਦਾ ਸੀ ਜਿਵੇਂ ਵੀ ਲੋਕਾਂ ਨੂੰ ਬੱਸ ਸਟੈਂਡ 'ਤੇ ਲੈਣਾ 'ਤੇ ਖਲੋਣਾ ਪੈਂਦਾ ਹੁੰਦਾ ਸੀ ਅਤੇ ਜਿਸ ਨਾਲ ਕਈ ਵਾਰ ਉਹ ਟਾਈਮ 'ਤੇ ਜਿੱਥੇ ਉਹਨਾਂ ਨੇ ਪਹੁੰਚਣਾ ਹੁੰਦਾ ਉੱਥੇ ਟਾਇਮ 'ਤੇ ਨਹੀਂ ਪਹੁੰਚਦੇ ਅਤੇ ਲੇਟ ਵੀ ਹੋ ਜਾਂਦੇ ਨੇ ਕਿਸੇ ਨੇ ਜਿੱਦਾਂ ਇਗਜ਼ਾਮ ਦੇਣ ਜਾਣਾ ਹੋਵੇ ਉੱਥੇ ਵੀ ਜੇ ਕਿਤੇ ਨੌਕਰੀ ਚੰਡੀਗੜ੍ਹ ਜਾਣਾ ਹੋਵੇ ਆਪਣੇ ਟਾਇਮ 'ਤੇ ਨਹੀਂ ਪਹੁੰਚਦੇ ਹੁਣ ਤਾਂ ਸਰਕਾਰ ਨੇ ਬਹੁਤ ਸਾਰਾ ਫਾਇਦਾ ਕੀਤਾ ਉਹਨਾਂ ਸਰ ਦੁਨੀ ਇਨ੍ਹਾਂ ਵਾਸਤੇ ਜਨਤਾ ਵਾਸਤੇ ਥੋੜ੍ਹਾ ਜਿਹਾ ਫਾਇਦਾ ਕੀਤਾ ਵੀ ਉਹਨਾਂ ਨੇ ਫਰੀ ਫਰੀ ਬੱਸ ਦੀ ਵੀ ਸਕੀਮ ਚਲਾਈ ਹੈ ਜਿੱਦਾਂ ਜਿੱਦਾਂ ਲੇਡੀਸ ਜਿੱਦਾਂ ਇਸਤਰੀਆਂ ਹੈਗੀਆਂ ਉਹਨਾਂ ਦਾ ਕਾ ਆਧਾਰ ਕਾਰਡ 'ਤੇ ਉਹਨਾਂ ਨੂੰ ਫਰੀ ਬੱਸ 'ਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਿਵੇਂ ਕਿਸੇ ਵੀ ਕਿਸੇ ਨੇ ਇਹਦੇ ਵਿੱਚ ਬੱਸਾਂ ਵਿੱਚ ਇਹ ਫਾਇਦਾ ਹੋ ਜਾਂਦਾ ਵੀ ਜਿਵੇਂ ਟਿਕਟ ਲੈਣ 'ਤੇ ਵੀ ਥੋੜ੍ਹੀ ਜਿਹੀ ਸੋਕਵਾਇਤੀ ਕਫਾ ਕਿਫਾਇਤੀ ਹੋ ਜਾਂਦਾ ਫਾਇਦਾ ਹੋ ਜਾਂਦਾ ਵੀ ਜਿਵੇਂ ਕਿਸੇ ਨੇ ਟਿਕਟ ਲੈਣੀ ਹੋਵੇ ਉਹਨਾਂ ਨੂੰ ਉੱਥੇ ਜਿੱਦਾਂ ਬੱਸ ਦੇ ਵਿੱਚ ਜਲਦੀ ਪਹੁੰਚਣਾ ਹੋਵੇ ਜਾਂ ਅਤੇ ਜਿੱਦਾਂ ਵੇਖ ਦੋ ਵੀ ਟ੍ਰੇਨ ਦੀ ਟਿਕਟ ਥੋੜ੍ਹੀ ਸਸਤੀ ਹੁੰਦੀ ਹੈ ਜੇ ਬੱਸਾਂ 'ਤੇ ਜਾਣਾ ਹੋਵੇ ਦੂਰ ਕਿਤੇ ਜਾਣਾ ਹੋਵੇ ਚੰਡੀਗੜ੍ਹ ਜਦੋਂ ਲੁਧਿਆਣੇ ਹੋਰ ਵੀ ਕਿਤੇ ਜਾਣਾ ਹੋਵੇ ਤਾਂ ਉੱਥੋਂ ਬਠਿੰਡਾ ਜਾਣਾ ਹੋਵੇ ਉੱਥੋਂ ਦੀ ਟਿਕਟ ਮਹਿੰਗੀ ਹੁੰਦੀ ਆ ਜਿੱਦਾਂ ਕਿਸੇ ਨੇ ਉਹ ਜਹਾਜ਼ ਰਾਹੀਂ ਜਾਣਾ ਹੋਵੇ ਉਹਨਾਂ ਦੀ ਟਿਕਟ ਮਹਿੰਗੀ ਹੁੰਦੀ ਆ ਇਸ ਕਰਕੇ ਜੇ ਅਸੀਂ ਬੱਸ ਦੀ ਮਦਦ ਲਵਾਂਗੇ ਤਾਂ ਉਹਦੇ ਨਾਲ ਥੋੜ੍ਹੀ ਜਿਹੀ ਸਾਨੂੰ ਟਿਕਟ ਸਾਡੀ ਥੋੜ੍ਹੀ ਜਿਹੀ ਸਸਤੀ ਪੈਜੂੰ ਪਰ ਉਹ ਵੀ ਟਾਇਮ ਥੋੜ੍ਹਾ ਜਿਹਾ ਲੱਗ ਜੂਗਾ ਪਰ ਸਾਨੂੰ ਟਿਕਟ ਥੋੜ੍ਹੀ ਜਿਹੀ ਸਸਤੀ ਮਿਲਜੂੰ ਅਰਾਮ ਨਾਲ ਜੇ ਸੀਟ ਮਿਲ ਗਈ ਤਾਂ ਬਹਿ ਕੇ ਅਸੀਂ ਜਾ ਸਕਦੇ ਹਾਂ ਥੈਂਕ ਯੂ